ਅੱਜ ਕੱਲ੍ਹ ਲਿਖਣ ਦਾ ਢੰਗ ਕਾਫੀ ਬਦਲ ਗਿਆ ਹੈ ਇਹ ਤਬਦੀਲੀਆਂ ਕਈ ਰੂਪਾਂ ਵਿੱਚ ਆਈਆਂ ਹਨ ਡਿਜੀਟਲ ਲਿਖਾਈ ਕਾਗਜ ਅਤੇ ਕਲਮ ਦੀ ਥਾਂ ਲੋਕ ਹੁਣ ਕੰਪਿਊਟਰ ਟੇਬਲੇਟ ਅਤੇ ਸਮਾਰਟ ਫੋਨ ਵਰਤ ਕੇ ਲਿਖਦੇ ਹਨ ਇਸ ਨਾਲ ਲਿਖਣਾ ਜ਼ਿਆਦਾ ਆਸਾਨ ਅਤੇ ਤੇਜ਼ ਹੋ ਗਿਆ ਹੈ ਸੋਸ਼ਲ ਮੀਡੀਆ ਸੋਸ਼ਲ ਮੀਡੀਆ ਦੇ ਆਉਣ ਨਾਲ ਲਿਖਣ ਦੀ ਸ਼ੈਲੀ ਬਦਲ ਗਈ ਹੈ ਹੁਣ ਲੋੜ ਹੈ ਕਿ ਲਿਖਤ ਅਤੇ ਪ੍ਰਭਾਵਸ਼ਾਲੀ ਹੋਵੇ ਟਵੀਟਸ ਪੋਸਟ ਅਤੇ ਕਮੈਂਟਸ ਦੇ ਰੂਪ ਵਿੱਚ ਲਿਖਤ ਛੋਟੇ ਅਤੇ ਸੰਕੰਸ਼ਿਪਿਤ ਹੋ ਗਏ ਹਨ ਭਾਸ਼ਾ ਅਤੇ ਸ਼ੈਲੀ ਇੰਟਰਨੈਟ ਅਤੇ ਗਲੋਬੀਨੇਸ਼ਨ ਕਾਰਨ ਲਿਖਤ ਵਿੱਚ ਮਿਸ਼ਨ ਭਾਸ਼ਾ ਦੀ ਵਰਤੋਂ ਵੱਧ ਗਈ ਹੈ ਲੋਕ ਕਈ ਵਾਰ ਇੱਕੋ ਇੱਕ ਵਾਕ ਵਿੱਚ ਅੰਗਰੇਜ਼ੀ ਅਤੇ ਆਪਣੀ ਮਾਤ ਭਾਸ਼ਾ ਦਾ ਮਿਸ਼ਨ ਕਰਦੇ ਹਨ ਸੰਪਾਦਨ ਅਤੇ ਪ੍ਰਕਾਸ਼ਣ ਪਹਿਲਾਂ ਲਿਖਤ ਨੂੰ ਛਾਪਣਾ ਇੱਕ ਮੁਸ਼ਕਿਲ ਕੰਮ ਸੀ ਪਰ ਹੁਣ ਬਲਾਗਸ ਈ ਬੁੱਕਸ ਅਤੇ ਸੋਸ਼ਲ ਮੀਡੀਆ ਪਲੇਟਫਾਰਮਾਂ ਨੇ ਇਸਨੂੰ ਬਹੁਤ ਆਸਾਨ ਬਣਾ ਦਿੱਤਾ ਹੈ ਕਿਸੇ ਵੀ ਲਿਖਾਰੀ ਨੂੰ ਹੁਣ ਆਪਣੀ ਲਿਖਤ ਪ੍ਰਕਾਸ਼ਿਤ ਕਰਨ ਲਈ ਪ੍ਰਿੰਟਰ ਦੀ ਲੋੜ ਨਹੀਂ ਭਾਸ਼ਾ ਮਲਟੀਮੀਡੀਆ ਲਿਖਤ ਅੱਜ ਕੱਲ੍ਹ ਲਿਖਤ ਵਿੱਚ ਤਸਵੀਰਾਂ ਵੀਡੀਓ ਅਤੇ ਆਡੀਓ ਕਲਿੱਪ ਵੀ ਸ਼ਾਮਿਲ ਕੀਤੇ ਜਾਂਦੇ ਨੇ ਇਸ ਨਾਲ ਪਾਠਕਾਂ ਦਾ ਧਿਆਨ ਜ਼ਿਆਦਾ ਖਿੱਚਿਆ ਜਾਂਦਾ ਹੈ ਅਤੇ ਸਮੱਗਰੀ ਜ਼ਿਆਦਾ ਦਿਲਚਸਪ ਬਣਦੀ ਹੈ ਇਹ ਸਾਰੀ ਤਬਦੀਲੀਆਂ ਇਹ ਦਰਸਾਉਂਦੀਆਂ ਹਨ ਕਿ ਲਿਖਣ ਦਾ ਢੰਗ ਸਮੇਂ ਦੇ ਨਾਲ ਨਾਲ ਕਿਵੇਂ ਅਨੁਕੂਲ ਹੁੰਦਾ ਜਾ ਰਿਹਾ ਹੈ